ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰੁਣ ਕੁਮਾਰ ਹੈ ਮੈਂ ਗੁਰਦਾਸਪੁਰ ਜਿਲ੍ਹੇ ਵਿੱਚ ਰਹਿੰਦਾ ਹਾਂ ਅੱਜ ਅਸੀਂ ਗੱਲ ਕਰਾਂਗੇ ਕਿ ਟੈਕਨੋਲਜੀ ਦੀ ਵਰਤੋਂ ਕਰਦੇ ਸਮੇਂ ਬਜ਼ੁਰਗਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਿਵੇਂ ਇਹ ਸੰਭਵ ਹੋ ਸਕਦਾ ਹੈ ਅਸਲ ਵਿੱਚ ਟੈਕਨੋਲੋਜੀ ਦੀ ਵਰਤੋਂ ਕਰਦੇ ਸਮੇਂ ਬਜ਼ੁਰਗਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਚੁਣੌਤੀਆਂ ਜ਼ਿਆਦਾਤਰ ਉਮਰ ਸਿਹਤ ਅਤੇ ਪਿਛੋਕੜ ਨਾਲ ਜੁੜੀਆਂ ਹੁੰਦੀਆਂ ਹਨ ਬਜ਼ੁਰਗਾਂ ਨੂੰ ਹਮੇਸ਼ਾ ਤੋਂ ਨਵੀਆਂ ਤਕਨੀਕਾਂ ਨੂੰ ਸਿੱਖਣ ਵਿੱਚ ਮੁਸ਼ਕਿਲ ਆਉਂਦੀ ਹੈ ਕਦੇ ਕਦੇ ਛੋਟੇ ਫੋਨ ਟੱਚ ਸਕਰੀਨ ਸਾਈਜ਼ ਕਰਕੇ ਦੇਖਣ ਵਿੱਚ ਪ੍ਰੋਬਲਮ ਆਉਂਦੀ ਹੈ ਆਵਾਜ਼ਾਂ ਸੁਣਨ ਵਿੱਚ ਸਮੱਸਿਆਵਾਂ ਜਿਵੇਂ ਕਿ ਆਡੀਓ ਨੋਟੀਫਿਕੇਸ਼ਨ ਸੁਣਨ ਵਿੱਚ ਮੁਸ਼ਕਿਲ ਹੁੰਦੀ ਹੈ ਬਜ਼ੁਰਗਾਂ ਨੂੰ ਹਮੇਸ਼ਾ ਤੋਂ ਠੱਗੀ ਅਤੇ ਸਾਈਬਰ ਅਪਰਾਧਾਂ ਦਾ ਖਰਤ ਖ਼ਤਰਾ ਵੱਧ ਜਾਂਦਾ ਹੈ ਪ੍ਰਾਈਵੇਸੀ ਦੇ ਬਾਰੇ ਉਹਨਾਂ ਨੂੰ ਸਮਝ ਘੱਟ ਹੁੰਦੀ ਹੈ ਹਮੇਸ਼ਾਂ ਤੋਂ ਹੀ ਨਵੀਂ ਤਕਨੀਕ ਦੀ ਵਰਤੋਂ ਕਰਨ ਨਾਲ ਡਰ ਅਤੇ ਭਰਮ ਬਣਿਆ ਰਹਿੰਦਾ ਹੈ ਟੈਕਨੋਲਜੀ 'ਤੇ ਭਰੋਸਾ ਕਰਨ ਵਿੱਚ ਉਹਨਾਂ ਨੂੰ ਹਮੇਸ਼ਾਂ ਝਿਜਕ ਮਹਿਸੂਸ ਹੁੰਦੀ ਹੈ ਜੇ ਆਪਾਂ ਇਹਨਾਂ ਦੇ ਹੱਲ ਦੀ ਗੱਲ ਕਰੀਏ ਕਿ ਉਹਨਾਂ ਨੂੰ ਕਿਵੇਂ ਇਸ ਦਾ ਹੱਲ ਕਰ ਸਕਦੇ ਹਾਂ ਤਾਂ ਇਸ ਲਈ ਵੱਖ ਵੱਖ ਕੋਰਸ ਜਾਂ ਵਰਕਸ਼ਾਪਾਂ ਨਾਲ ਬਜ਼ੁਰਗਾਂ ਨੂੰ ਟੈਕਨੋਲੋਜੀ ਸਿਖਾਈ ਜਾ ਸਕਦੀ ਹੈ ਪਰਿਵਾਰ ਦੇ ਮੈਂਬਰ ਵੀ ਬਜ਼ੁਰਗਾਂ ਨੂੰ ਸਹਿਯੋਗ ਨਾਲ ਸਿਖਾ ਸਕਦੇ ਹਨ ਜੇ ਬਜ਼ੁਰਗਾਂ ਨੂੰ ਦੇਖਣ ਵਿੱਚ ਕੋਈ ਸਮੱਸਿਆਵਾਂ ਆਉਂਦੀ ਹੈ ਤਾਂ ਉਹਨਾਂ ਲਈ ਫੋਂਟ ਵੱਡੇ ਕਰ ਦੇਣੇ ਚਾਹੀਦੇ ਹਨ ਬਜ਼ੁਰਗਾਂ ਨੂੰ ਹਮੇਸ਼ਾ ਆਸਾਨ ਪਾਸਵਰਡ ਰੱਖਣ ਵਿੱਚ ਮਦਦ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਠੱਗੀ ਅਤੇ ਸਾਈਬਰ ਅਪਰਾਧ ਦੀ ਕੋਈ ਸਾਵਧਾਨੀ ਹੋਣੀ ਚਾਹੀਦੀ ਹੈ ਤਾਂ ਸਮੇਂ ਸਮੇਂ 'ਤੇ ਉਹਨਾਂ ਦੇ ਫੋਨਾਂ 'ਤੇ ਚੇਤਾਵਨੀ ਮਿਲਣੀ ਚਾਹੀਦੀ ਹੈ ਬਜ਼ੁਰਗਾਂ ਨੂੰ ਨਵੀਂ ਤਕਨੋਲੋਜੀ ਸਿੱਖਣ ਲਈ ਹਮੇਸ਼ਾ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਟੈਕਨੋਲੋਜੀ ਸਿੱਖਣ ਵਿੱਚ ਉਹਨਾਂ ਨੂੰ ਕਦੇ ਜਲਦੀ ਨਹੀਂ ਕਰਨੀ ਚਾਹੀਦੀ ਹੌਲੀ ਹੌਲੀ ਧੀਰਜ ਨਾਲ ਉਹਨਾਂ ਨੂੰ ਸਿਖਾਉਣੀ ਚਾਹੀਦੀ ਹੈ ਅਤੇ ਇਹ ਹੱਲ ਬਜ਼ੁਰਗਾਂ ਨੂੰ ਟੈਕਨੋਲੋਜੀ ਦੀ ਵਰਤੋਂ ਵਿੱਚ ਮਦਦ ਕਰ ਸਕਦੇ ਹਨ ਧੰਨਵਾਦ